ਭੰਗੜਾ ਪੰਜਾਬ ਦਾ ਇੱਕ ਲੋਕ ਪ੍ਰਸਿੱਧ ਨਾਚ ਹੈ ਜਿਸ ਵਿੱਚ ਬਹੁਤ ਜ਼ਿਆਦਾ ਜੋਸ਼ ਭਰੇ ਸਟੈਪ ਹੁੰਦੇ ਹਨ ਐਸ ਨਾਚ ਵਿੱਚ ਲਗਾਤਾਰ ਲੈਅਬੱਧ ਬੋਲ ਹੁੰਦੇ ਹਨ ਐਸ ਨਾਚ ਨੂੰ ਲਗਾਤਾਰ ਸੱਠ ਮਿੰਟ ਕਰਨ 'ਤੇ ਛੇ ਸੌ ਕੈਲਰੀ ਤੱਕ ਦੀ ਖਪਤ ਹੁੰਦੀ ਹੈ ਐਸੇ ਕਰਕੇ ਐਸ ਨੂੰ ਐਰੋਬਿਕਸ ਨਾਲ ਵੀ ਜੋੜਿਆ ਜਾਂਦਾ ਹੈ ਹਾਲਾਂਕਿ ਐਸ ਲਈ ਐਨ ਭੰਗੜਾ ਐਰੋਬਿਕਸ ਲਈ ਕੋਈ ਖਾਸ ਮੁਕਾਬਲੇ ਨਹੀਂ ਹੁੰਦੇ ਪਰ ਫਿਰ ਵੀ ਵੱਖ ਵੱਖ ਪੱਧਰ 'ਤੇ ਵੱਖੋ ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਕੁਝ ਭੰਗੜਾ ਐਰੋਬਿਕਸ ਦੇ ਮੁਕਾਬਲੇ ਨਿੱਜੀ ਤੋਰ 'ਤੇ ਕਰਵਾਏ ਜਾਂਦੇ ਹਨ ਅਤੇ ਕੁਝ ਉਸ ਨੂੰ ਕਿੱਤੇ ਦੇ ਤੋਰ 'ਤੇ ਵੀ ਕਰਵਾਏ ਜਾਂਦੇ ਹਨ